ਪੰਜਾਬ ਵਿੱਚ ਚਾਰ ਅੱਤਰ ਚਾਰ ਹੀ ਭਾਈਚਾਰੇ ਪ੍ਰਸਿੱਧ ਹਨ ਜਿਨ੍ਹਾਂ ਵਿੱਚੋਂ ਪਹਿਲਾਂ ਭਾਈਚਾਰਾ ਹੈ ਸਿੱਖ ਭਾਈਚਾਰਾ ਦੂਸਰਾ ਹੈ ਹਿੰਦੂ ਭਾਈਚਾਰਾ ਤੀਸਰਾ ਹੈ ਮੁਸਲਿਮ ਭਾਈਚਾਰਾ ਚੌਥਾ ਹੈ ਇਥਾਹੀ ਭਾਈਚਾਰਾ ਇਨ੍ਹਾਂ ਸਾਰੇ ਧਾਰਮਿਕ ਭਾਈਚਾਰਿਆਂ ਦੇ ਅਲੱਗ ਅਲੱਗ ਸਥਾਨ ਹਨ ਜਿਨ੍ਹਾਂ ਨੂੰ ਇਹ ਅਲੱਗ ਅਲੱਗ ਨਾਂ ਨਾਲ ਬੁਲਾਉਂਦੇ ਹਨ ਅਗਰ ਅਸੀਂ ਭਾਈਚਾਰੇ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਧਾਰਮਿਕ ਅਸਥਾਨ ਚਰਚ ਹੈ ਜਿਸ ਵਿੱਚ ਇਨ੍ਹਾਂ ਦੇ ਗੁਰੂ ਜਿਸਮੀਸੀ ਦੀ ਮੂਰਤੀ ਹੁੰਦੀ ਹੈ ਅਤੇ ਇਹ ਉੱਥੇ ਜਾ ਕੇ ਆਪਣੀ ਪ੍ਰੇਅਰ ਵਗੈਰਾ ਕਰਦੇ ਹਨ ਅਤੇ ਅਗਰ ਦੂਸਰੇ ਧਰਮ ਦੀ ਗੱਲ ਕੀਤੀ ਜਾਵੇ ਹਿੰਦੂ ਧਰਮ ਦੀ ਗੱਲ ਕੀਤੀ ਜਾਵੇ ਤਾਂ ਉਹ ਧਰਮ ਧਰਮ ਵਿੱਚ ਇਨ੍ਹਾਂ ਦੇ ਧਾਰਮਿਕ ਅਸਥਾਨ ਨੂੰ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿੱਥੇ ਕਿ ਇਨ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਨ ਅਗਰ ਤੀਸਰੇ ਧਰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਮੁਸਲਿਮ ਧਰਮ ਅਗਰ ਮੁਸਲਿਮ ਧਰਮ ਦੀ ਗੱਲ ਕਰੀਏ ਤਾਂ ਉਸ ਧਰਮ ਵਿੱਚ ਇਨ੍ਹਾਂ ਦੇ ਧਾਰਮਿਕ ਅਸਥਾਨ ਨੂੰ ਮਸਜਿਦ ਨਾਂ ਨਾਲ ਜਾਣਿਆ ਜਾਂਦਾ ਹੈ ਮਸਜਿਦ ਵਿੱਚ ਇਹ ਆਪਣਾ ਨਮਾਜ਼ ਨੂੰ ਅਦਾ ਕਰਦੇ ਹਨ ਜੋ ਕਿ ਇਨ੍ਹਾਂ ਦੇ ਗੁਰੂਆਂ ਵੱਲੋਂ ਕਿਹਾ ਗਿਆ ਹੈ ਕਿ ਨਮਾਜ਼ ਨੂੰ ਅਤ ਰੋਜ਼ ਅਦਾ ਕਰਨਾ ਹੈ ਇਹ ਉੱਥੇ ਜਾ ਕੇ ਆਪਣੀ ਨਮਾਜ਼ ਨੂੰ ਅਦਾ ਕਰਦੇ ਹਨ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਨ ਅਗਰ ਚੌਥੇ ਧਰਮ ਦੀ ਅਗਰ ਗੱਲ ਕੀਤੀ ਜਾਵੇ ਸਿੱਖ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਅਸਥਾਨ ਗੁਰਦੁਆਰਾ ਹੈ ਜਿੱਥੇ ਕਿ ਜਾ ਕੇ ਆਪਣਾ ਪਾਠ ਕਰਦੇ ਹਨ ਅਤੇ ਆਪਣੇ ਗ੍ਰੰਥਾਂ ਨੂੰ ਪੜ੍ਹਦੇ ਹਨ ਕਿਉਂਕਿ ਉਨ੍ਹਾਂ ਦੇ ਗੁਰੂਆਂ ਨੇ ਕਿਹਾ ਹੈ ਕਿ ਗੁਰੂ ਨੂੰ ਹੀ ਤੁਸੀਂ ਹੁਣ ਗ੍ਰੰਥ ਮੰਨਣਾ ਹੈ ਤਾਂ ਉਹ ਗੁਰੂ ਨੂੰ ਹੀ ਗ੍ਰੰਥ ਮੰਨ ਕੇ ਆਪਣੇ ਗੁਰਦੁਆਰਿਆਂ ਵਿੱਚ ਉਨ੍ਹਾਂ ਨੇ ਉਸ ਨੂੰ ਗ੍ਰੰਥ ਨੂੰ ਹੀ ਬਿਰਾਜਮਾਨ ਕੀਤਾ ਹੈ ਆਪਣੇ ਗੁਰੂ ਦੇ ਵਜੋਂ ਅਤੇ ਉਨ੍ਹਾਂ ਦੇ ਅੱਗੇ ਸਿ ਸਿਰ ਝੁਕਾਉਂਦੇ ਹਨ ਅਤੇ ਸਾਰੇ ਦੁਨੀਆਂ ਨੂੰ ਹੀ ਦੱਸਦੇ ਹਨ ਉਨ੍ਹਾਂ ਦੇ ਗੁਰੂਆਂ ਬਾਰੇ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਨ